ਹਾਂਜੀ ਭਾਰਤ ਬੁੱਕ ਡਿਪੂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਦਸ ਦਿਓ ਕਿਹੜੇ ਕਿਹੜੇ ਸਬਜੈਕਟਾਂ ਦੀਆਂ ਲੈਣੀਆਂ ਹੈਗੀਆਂ ਸਾਡੇ ਕੋਲ ਤਕਰੀਬਨ ਹਰ ਤਰ੍ਹਾ ਦੀਆਂ ਮੌਜੂਦ ਹੈਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਇੱਥੋਂ ਸਾਰੀਆਂ ਮਿਲ ਜਾਣਗੀਆਂ

ਹਾਂਜੀ ਹਾਂਜੀ ਨਹੀਂ ਨਹੀਂ ਜੀ ਨਵੇਂ ਆਡੀਸ਼ਨ ਦੀਆਂ ਹੈਗੀਆਂ ਵਧੀਆ ਹਾਲਤ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਉਹ ਅਸੀਂ ਹਾਲਤ ਵੇਖ ਕੇ ਲੈਂਦੇ ਹਾਂ ਜੀ ਤੁਸੀਂ ਸਾਡੇ ਕੋਲ ਲੈ ਆਇਓ ਆਪਣੀਆਂ ਕਿਤਾਬਾਂ ਅਤੇ ਅਸੀਂ ਦੇਖ ਲਵਾਂਗੇ ਜਿਹੋ ਜਿਹੀ ਉਹਨਾਂ ਦੀ ਹਾਲਤ ਹੋਈ ਉਸ ਹਿਸਾਬ ਨਾਲ ਤੁਹਾਨੂੰ ਵੈਸੇ ਸਾਡਾ ਤੀਹ ਉਹਨਾਂ ਦਾ ਤੀਹ ਪਰਸੈਂਟ ਦੇ ਦਿੰਦੇ ਹਾਂ